ਸਾਹਮਣਾ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਿ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਵੀ ਸਾਡਾ ਪੈਰ ਦਾ ਜਿਹੜਾ ਸਲਿੱਪ ਨਾ ਹੋ ਜਾਵੇ ਅਤੇ ਇਸ ਲਈ ਸਾਨੂੰ ਇਸ ਲਈ ਸਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਵੀ ਫੋਟੋਆਂ ਖਿੱਚਣ ਦੇ ਨਾਲ ਨਾਲ ਸਾਨੂੰ ਆਪਣੇ ਪਰਿਵਾਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੇ ਕੋਈ ਵੀ ਅਨਸਕੇਬੀ ਘਟਨਾ ਸਾਡੇ ਨਾਲ ਨਾ ਵਾਪਰ ਜਾਵੇ ਇਸ ਲਈ ਮੇਰਾ ਮੰਨਣਾ ਹੈ ਵੀ ਜਦੋਂ ਵੀ ਕੋਈ ਪਹਾੜੀ ਇਲਾਕੇ ਵਿੱਚ ਜਾਓ ਤਾਂ ਫੋਟੋਆਂ ਜਿਹੜੀਆਂ ਖਿੱਚਣ ਉਹ ਰਸਤੇ ਵਿੱਚ ਕਿਤੇ ਨਹੀਂ ਇੱਦਾਂ ਰੁਕਣਾ ਚਾਹੀਦਾ ਹੈ ਅਤੇ ਇਸ ਲਈ ਤੁਹਾਨੂੰ ਆਪਣੀ ਮੰਜ਼ਿਲ 'ਤੇ ਪਹੁੰਚ ਕੇ ਹੀ ਆਪਣੇ ਹੋਟਲ ਵਿੱਚ ਤੁਸੀਂ ਫੋਟੋਆਂ ਖਿੱਚ ਸਕਦੇ ਹੋ ਅਤੇ ਕੋਈ ਗਰਾਉਂਡ ਹੈ ਖੁੱਲ੍ਹਾ ਉਹਦੇ ਵਿੱਚ ਅਸੀਂ ਫੋਟੋਆਂ ਖਿੱਚ ਸਕਦੇ ਹਾਂ ਜਾਨੀ ਕਿ ਉਸ ਜਗ੍ਹਾ 'ਤੇ ਫੋਟੋਆਂ ਜਾ ਕੇ ਖਿੱਚ ਸਕਦੇ ਹੋ ਜਿੱਥੇ ਤੁਹਾਡਾ ਕੋਈ ਤੁਹਾਡੇ ਨਾਲ ਅਨਸਖਾਵੀ ਘਟਨਾ ਵਾਪਰਨ ਦੇ ਚਾਂਸ ਜੀਰੋ ਹੋ ਜਾਂਦੇ ਹਨ